ਪਿਛਲੇ ਦਿਨੀ ਹੀ ਸਾਡੇ ਪਿੰਡ ਵਿੱਚ ਇੱਕ ਖਾਣਾ ਪਕਾਉਣ ਦੇ ਮੁਕਾਬ ਖਾਣਾ ਪਕਾਉਣ ਦਾ ਮੁਕਾਬਲਾ ਹੋਇਆ ਸੀ ਜਿਸ ਵਿੱਚ ਸਾਡੇ ਪਿੰਡ ਦੀਆਂ ਕੁੜੀਆਂ ਔਰਤਾਂ ਬਹੂਆਂ ਨੂੰਹਾਂ ਦਾਦੀਆਂ ਅਤੇ ਮੁੰਡਿਆਂ ਅਤੇ ਨੌਜਵਾਨਾਂ ਨੇ ਵੀ ਹਿੱਸਾ ਲਿਆ ਸੀ ਇਸ ਮੁਕਾਬਲੇ ਵਿੱਚ ਮੈਂ ਵੀ ਹਿੱਸਾ ਲਿਆ ਸੀ ਇਸ ਮੁਕਾਬਲੇ ਵਿੱਚ ਤਿੰਨ ਰਾਊਂਡ ਸਨ ਪਹਿਲੇ ਰਾਊਂਡ ਵਿੱਚ ਬਰੇਕਫਾਸਟ ਬਣਾਉਣਾ ਸੀ ਦੂਜੇ ਵਿੱਚ ਲੰਚ ਬਣਾਉਣਾ ਸੀ ਅਤੇ ਤੀਜੇ ਵਿੱਚ ਡਿਨਰ ਸ ਇਹ ਇਹ ਮੁਕਾਬਲਾ ਪਿੰਡ ਪਿੰਡ ਦੇ ਗਰਾਊਂਡ ਵਿੱਚ ਲਗਾਇਆ ਗਿਆ ਸੀ ਜਿਸ ਵਿੱਚ ਸਾਰੇ ਪਿੰਡ ਦੇ ਲੋਕ ਸ਼ਾਮਿਲ ਸਨ ਅਤੇ ਦੇਖਣ ਲ ਦੇਖ ਅਤੇ ਇਹ ਮੁਕਾਬਲਾ ਦੇਖਣ ਲਈ ਆਏ ਸਨ ਪਿੰਡ ਦੇ ਗਰਾਉਂਡ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ ਹਰ ਇੱਕ ਕੈਂਡੀਡੇਟ ਅਤੇ ਹਰ ਇੱਕ ਕੋਂਸ ਕੋਂਨਟੈਸਟ ਦੇ ਲਈ ਸਟੋਲਸ ਲਗਾਈਆਂ ਹੋਈਆਂ ਸਨ ਸਾਰੇ ਲੋਕਾਂ ਨੇ ਇਸਦਾ ਬਹੁਤ ਆਨੰਦ ਲਿਆ ਸੀ ਅੰਤ ਵਿੱਚ ਜਿੱਤਣ ਵਾਲੇ ਖਿਡਾਰੀਆਂ ਜਿੱਤਣ ਵਾਲੇ ਖਿਡਾਰੀਆਂ ਜਿੱਤਣ ਵਾਲੇ ਪ੍ਰਤੀਯੋਗੀਆਂ ਜਿੱਤਣ ਵਾਲੇ ਪ੍ਰਤੀਯੋਗੀਆਂ ਨੂੰ ਇਨਾਮ ਵੀ ਦਿੱਤੇ ਗਏ ਸਨ